ਹੈਲੋ ਹਾਂਜੀ ਦੀ ਸੰਦੀਪ ਜੀ ਕਿਵੇਂ ਹੋ ਵਧੀਆ ਵਧੀਆ ਜੀ ਸੂਟ ਪਹੁੰਚ ਗਿਆ ਮੇਰਾ ਅੱਛਾ ਤੁਹਾਡੇ ਕੋਲ ਹੈ ਹੈਗਾ ਸੀ ਨਾ ਮੇਰਾ ਮੇਚਾ ਅੱਛਾ ਕੋਈ ਨਾ ਕੋਈ ਨਾ ਜੀ ਮੇਰੇ ਤੋਂ ਲੈ ਲਓ ਮੇਚਾ ਲੈਣਾ ਤਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕਮੀਜ਼ ਦੀ ਲੈਂਥ ਹੈਗੀ ਆ ਜੀ ਬਿਆਲੀ ਇੰਚ ਹਾਂਜੀ ਮੇਰਾ ਤੀਰਾ ਹੈਗਾ ਬਾਰਾਂ ਇੰਚ ਹਾਂਜੀ ਛਾਤੀ ਹੈਗੀ ਹੈ ਸਤਾਰਾਂ ਇੰਚ ਕਮਰ ਹੈਗੀ ਹੈ ਪੰਦਰਾਂ ਹਿੱਪ ਹੈਗੀ ਹੈ ਸਾਢੇ ਸਤਾਰਾਂ ਉਹ ਹੈਗੀਆਂ ਜੀ ਗਿਆਰਾਂ ਇੰਚ ਬਾਜੂ ਹੈਗੀ ਹੈ ਮੇਰੀ ਕਿੰਨੀ ਲਿਖੀ ਬਾਜੂ ਹੈ ਸੋਲਾਂ ਪੰਜ ਸਲਵਾਰ ਹੈਗੀ ਹੈ ਪੈਂਤੀ ਇੰਚ

ਸਾਢੇ ਪੰਜ ਹਾਂਜੀ ਕਿੰਨੇ ਕੁ ਦਿਨਾਂ ਤੱਕ ਸਟਿੱਚ ਕਰ ਦੋਂਗੇ ਮੈਨੂੰ ਤਾਂ ਬਸ ਦੋ ਕੁ ਦਿਨਾਂ ਤੱਕ ਹੀ ਚਾਹੀਦਾ ਹਾਂਜੀ ਜ਼ਰੂਰ ਹਾਂਜੀ ਹਾਂਜੀ ਜ਼ਰੂਰ ਦੱਸਿਓ ਜ਼ਰੂਰ ਵਧੀਆ ਸਟਿੱਚ ਕਰਕੇ ਦੇ ਦਿਓ ਠੀਕ ਹੈ ਹਾਂਜੀ ਹਾਂਜੀ ਜਮਾਂ ਨਾਪ ਜਮਾਂ ਨਹੀਂ ਨਹੀਂ ਕਹਿੰਦੇ ਜੀ ਜਮਾਂ ਸਹੀ ਹੈ ਜੀ ਇਹ ਹੀ ਨਾਪ ਹੈ ਮੇਰਾ ਠੀਕ ਹ ਜੀ ਓਕੇ